ਮੈਨੂੰ ਦੌੜਨ ਤੋਂ ਬਾਅਦ ਬਹੁਤ ਅੇਰ ਆਰਾਮ ਮਹਿਸੂਸ ਹੁੰਦਾ ਹੈ ਕਿਉਂਕਿ ਮੈਨੂੰ ਦੌੜਨਾ ਅਤੇ ਯੋਗਾ ਕਰਨਾ ਬਹੁਤ ਪਸੰਦ ਹੈ ਮੈਂ ਸਵੇਰੇ ਹਰ ਰੋਜ਼ ਸਵੇਰੇ ਉੱਠ ਕੇ ਦੌੜਦੀ ਹਾਂ ਅਤੇ ਉਸ ਤੋਂ ਬਾਅਦ ਯੋਗਾ ਕਰਦੀ ਹਾਂ ਇਹ ਕਰਨ ਨਾਲ ਸਰੀਰ ਵਿੱਚ ਤੰਦਰੁਸਤੀ ਆਉਂਦੀ ਹੈ ਅਤੇ ਫੁਰਤੀ ਆਉਂਦੀ ਹੈ ਦੌੜਨ ਨਾਲ ਸਰੀਰ ਐਡਰੋਫੇਨ ਜਾਰੀ ਕਰਦਾ ਹੈ ਜੋ ਖੁਸ਼ੀ ਅਤੇ ਆਰਾਮ ਨੂੰ ਅਨੁਭਵ ਨੂੰ ਵ ਅਨੁਭਵਾਂ ਨੂੰ ਵਧਾਉਂਦਾ ਹੈ ਤਣਾਅ ਅਤੇ ਘਟਾ ਜਦੋਂ ਤੁਸੀਂ ਦੌੜਦੇ ਹੋ ਤਾਂ ਇਹ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਤਣਾਅ ਦੇ ਲੱਛਣ ਘਟਾਉਂਦਾ ਹੈ ਮਨਸ਼ਾ ਵਿੱਚ ਸੁਧਾਰ ਦੌੜਨ ਨਾਲ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਵੱਧਦੀ ਹੈ ਜਿਸ ਨਾਲ ਮਨ ਸ਼ਾਂਤ ਅਤੇ ਫੋਕਸ ਬਣਾਉਣ ਵਿੱਚ ਮਦਦ ਮਿਲਦੀ ਹੈ ਉਰਜਾ ਦਾ ਵਾਧਾ ਨਿਯਮਤ ਦੌੜਨ ਨਾਲ ਸਰੀਰ ਦੀ ਊਰਜਾ ਵੱਧਦੀ ਹੈ ਜਿਸ ਨਾਲ ਦਿਨ ਦੀਆਂ ਕਿਰਿਆਵਾਂ ਵਿੱਚ ਜ਼ਿਆਦਾ ਉਤਸ਼ਾਹ ਮਹਿਸੂਸ ਹੁੰਦਾ ਹੈ ਆਤਮ ਵਿਸ਼ਵਾਸ ਦੌੜਨ ਦੇ ਨਤੀਜੇ ਦੇ ਤੌਰ 'ਤੇ ਆਪਣੇ ਉੱਦਮ ਵਿੱਚ ਵਿਕਾਸ ਅਤੇ ਆਤਮ ਵਿਸ਼ਵਾਸ ਵੱਧਦਾ ਹੈ ਇਸ ਤਰ੍ਹਾਂ ਦੌੜਨ ਤੋਂ ਬਾਅਦ ਆਰਾਮ ਅਤੇ ਤੰਦਰੁਸਤੀ ਦਾ ਅਨੁਭਵ ਹੋਣ ਦਾ ਇਹ ਇੱਕ ਸ ਸਭ ਕਾਰਨ ਬਣਦੇ ਹਨ ਦੌੜਨ ਦੇ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਅਤੇ ਸਾਰਾ ਦਿਨ ਸਰੀਰ ਥਕਾਵਟ ਬਿਲਕੁਲ ਵੀ ਮਹਿਸੂਸ ਨਹੀਂ ਕਰਦਾ ਜਦੋਂ ਸਵੇਰੇ ਉੱਠਦੇ ਹਾਂ ਤਾਂ ਆਪਣੇ ਆਪ ਹੀ ਦਿਲ ਕਰਦਾ ਹੈ ਕਿ ਮੈਂ ਦੌੜਨ ਲੱਗ ਜਾਵਾਂ ਜੋ ਦੌੜ ਕੇ ਸਰੀਰ ਨੂੰ ਵਿੱ ਨੂੰ ਇੱਕੋ ਦਮ ਸਾਹ ਚੜ੍ਹਦਾ ਹੈ ਤਾਂ ਉਸ ਤੋਂ ਬਾਅਦ ਹੌ ਹੌਲੀ ਹੌਲੀ ਆਰਾਮ ਮਿਲਣਾ ਮਹਿਸੂਸ ਹੋ ਜਾਂਦਾ ਹੈ ਇੱਕ ਦੋ ਵਾਰ ਜਦੋਂ ਆਪਾਂ ਪਹਿਲਾਂ ਦੌੜਨਾ ਸ਼ੁਰੂ ਕਰਦੇ ਹਾਂ ਤਾਂ ਥੋੜ੍ਹਾ ਅਸੀਂ ਥਕਾਵਟ ਮਹਿਸੂਸ ਹੁੰਦੀ ਹੈ ਜਿਉਂ ਆਪਾਂ ਦੌੜਨਾ ਸ਼ੁਰੂ ਕਰ ਦਿੰਦੇ ਹਾਂ ਹਰ ਰੋਜ਼ ਜਦੋਂ ਆਪਾਂ ਨਿਤਨੇਮ ਇਹੀ ਕਰਦੇ ਰਹਿੰਦੇ ਹਾਂ ਤਾਂ ਹੀ ਆਦਤ ਜਿਹੀ ਬਣ ਜਾਂਦੀ ਹੈ ਤਾਂ ਬਿਨਾ ਜਾ ਦੌੜਨ ਤੋਂ ਸਰੀਰ ਥਕੇ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਸਵੇਰੇ ਜ਼ਰੂਰ ਦੌੜਨਾ ਚਾਹੀਦਾ ਹੈ ਅਤੇ ਯੋਗਾ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਸਰੀਰ ਤੰਦਰੁਸਤ ਰਹਿ ਸਕੇ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲ ਸਕੇ